ਹਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਜਿਹੜੀ ਇੱਕ ਸਮੇਂ ਦੀ ਲੋੜ ਵੀ ਬਣ ਚੁੱਕੀ ਹੈ ਕਿਉਂਕਿ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਪਿਛਲੇ ਸਮੇਂ ਵਿੱਚ ਹੋ ਹੀ ਬਹੁਤ ਗਈ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਲੋੜ ਜ਼ਰੂਰ ਹੈ ਸਮੇਂ ਦੀ ਕਿਉਂਕਿ ਜਿੰਨੀ ਤਪਸ਼ ਵੱਧ ਰਹੀ ਹੈ ਉਹ ਰੁੱਖਾਂ ਦੇ ਕਾਰਨ ਜਾਂ ਰੁੱਖਾਂ ਦੇ ਕੱਟੇ ਜਾਣ ਕਾਰਨ ਹੀ ਆ ਸਾਡੇ ਇਲਾਕੇ ਦੇ ਵਿੱਚ ਲੋਕ ਜਿਹੜੇ ਵੱਖ ਵੱਖ ਉਪਰਾਲੇ ਆ ਰੁੱਖ ਲਗਾਉਣ ਲਈ ਉਹ ਕਰਦੇ ਰਹਿੰਦੇ ਆ ਜਿਨ੍ਹਾਂ ਵਿੱਚੋਂ ਕੁਝ ਤਾਂ ਜਿਹੜੀਆਂ ਸਰਕਾਰੀ ਸੰਸਥਾਵਾਂ ਦੁਆਰਾ ਜਿਵੇਂ ਆਈ ਹਰਿਆਲੀ ਆ ਜਾਂ ਨੰਨ੍ਹੀ ਛਾਂ ਦੇ ਤਹਿਤ ਜਿਹੜਾ ਬੂਟਿਆਂ ਦਾ ਲੰਗਰ ਆ ਉਹ ਜਿਹੜਾ ਲਾਇਆ ਜਾਂਦਾ ਵੱਖ ਥਾਵਾਂ 'ਤੇ ਜਦੋਂ ਬਰਸਾਤਾਂ ਦਾ ਟਾਈਮ ਹੁੰਦਾ ਪੰਜਾਬ ਦੇ ਵਿੱਚ ਖਾਸਕਰ ਜੁਲਾਈ ਅਗਸਤ ਦੇ ਵਿੱਚ ਉਦੋਂ ਜਿਹੜੇ ਜ਼ਿਆਦਾਤਰ ਬੂਟੇ ਆ ਉਹ ਫਰੀ ਵੰਡੇ ਜਾਂਦੇ ਆ ਲੰਗਰ ਦੇ ਤਹਿਤ ਵੰਡੇ ਜਾਂਦੇ ਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਹਰਿਆਲੀ ਆ ਉਹ ਹੋ ਸਕੇ ਅਤੇ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਅਸੀਂ ਸੋਚਦੇ ਹਾਂ ਕਿ ਜ਼ਿਆਦਾ ਜਿਹੜੀ ਕਟਾਈ ਆ ਰੁੱਖਾਂ ਦੀ ਨਹੀਂ ਹੋਣੀ ਚਾਹੀਦੀ ਜਿੱਥੋਂ ਰੁੱਖ ਕਿਉਂਕਿ ਸੜਕਾਂ ਬਣਾਉਣ ਲਈ ਜਾਂ ਕੋਈ ਬਿਲਡਿੰਗ ਬਣਾਉਣ ਲਈ ਜਿੱਥੇ ਰੁੱਖ ਕੱਟੇ ਜਾਂਦੇ ਆ ਤਾਂ ਉਹਦੇ ਲਈ ਜ਼ਰੂਰੀ ਇਹ ਹੁੰਦਾ ਕਿ ਪਹਿਲਾਂ ਉੱਥੇ ਰੁੱਖ ਲਗਾਏ ਜਾਣ ਕੋਈ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਜਦੋਂ ਕਿਉਂਕਿ ਨਾਲ ਨਾਲ ਉਹ ਵੱਡੇ ਹੋ ਜਾਣ ਰੁੱਖ ਤ ਤਾਂ ਜਿਹੜੇ ਉਹ ਪੁਰਾਣੇ ਰੁੱਖ ਆ ਉਹ ਕੱਟੇ ਜਾ ਜਾ ਸਕਦੇ ਆ ਕਿਉਂਕਿ ਇੱਕਦਮ ਰੁੱਖਾਂ ਨੂੰ ਕੱਟ ਕੇ ਤਾਂ ਜਦੋਂ ਬਾਅਦ ਵਿੱਚ ਰੁੱਖ ਲਗਾਏ ਜਾਂਦੇ ਆ ਤਾਂ ਉਹ ਵੱਡੇ ਹੋਣ ਲਈ ਜਾਂ ਉਹਨਾਂ ਵਰਗੇ ਹੋਣ ਲਈ ਕਾਫੀ ਸਮਾਂ ਜਿਹੜਾ ਉਹ ਲੈ ਜਾਂਦੇ ਆ ਅਤੇ ਜਿਸ ਦੇ ਵਿਚਾਲੇ ਇਹ ਸਮੇਂ ਦੇ ਵਿਚਾਲੇ ਜਿਹੜੀ ਉਹ ਰੁੱਖਾਂ ਦੀ ਘਾਟ ਆ ਉਹ ਮਹਿਸੂਸ ਹੋਣ ਲੱਗਦੀ ਆ ਤਾਂ ਵੱਧ ਤੋਂ ਵੱਧ ਜਿਹੜੇ ਉਪਰਾਲੇ ਆ ਉਹ ਹੋਣੇ ਚਾਹੀਦੇ ਰੁੱਖਾਂ ਲਈ ਅਤੇ ਕਟਾਈ ਹੈ ਜਿਹੜੀ ਉਹ ਉਸ ਤੋਂ ਸੰਕੋਚ ਕੀਤਾ ਜਾਵੇ ਕਿ ਘੱਟ ਤੋਂ ਘੱਟ ਜਿਹੜੀ ਕਟਾਈ ਉਹ ਹੋਵੇ ਰੁੱਖਾਂ ਦੀ